ਕੀ ਤੁਸੀਂ ਅਰਵਰ ਕੈਬ ਤੋਂ ਗੱਲ ਕਰ ਰਹੇ ਹੋ ਮੈਨੂੁੰ ਕੈਬ ਬੁੱਕ ਕਰਾਉਣੀ ਸੀ ਆਪਣੇ ਆਫਿਸ ਤੱਕ ਜਾਣ ਲਈ ਮੈਨੂੰ ਮੇਰੇ ਆਫਿਸ ਤੋਂ ਪੰਦਰਾਂ ਮਿੰਟ ਲੱਗਣਗੇ ਉੱਥੇ ਪੁੱਜਣ ਲਈ ਮੈਂ ਤੁਹਾਨੂੰ ਪੇਮੈਂਟ ਸਿਰਫ ਨਕਦੀ ਵਿੱਚ ਹੀ ਕਰ ਸਕਦੀ ਹਾਂ ਤੁਹਾਡਾ ਧੰਨਵਾਦ ਤੁਸੀਂ ਮੈਨੂੰ ਇੱਥੇ ਤੱਕ ਡਰੋਪ ਕੀਤਾ ਪਰ ਮੈਂ ਤੁਹਾਨੂੰ ਪੇਮੈਂਟ ਨਕਦੀ ਵਿੱਚ ਹੀ ਦੇਵਾਂਗੀ ਮੇਰੇ ਕੋਲ ਹੋਰ ਕੋਈ ਮੈਥਡ ਨਹੀਂ ਹੈ ਤੁਹਾਨੂੰ ਪੇਮੈਂਟ ਅਦਾ ਕਰਨ ਦਾ ਪਰ ਜੇਕਰ ਤੁਸੀਂ ਕੋਈ ਹੋਰ ਮੈਥਡ ਨਾਲ ਪੇਮੈਂਟ ਲੈਣਾ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਥੋੜ੍ਹੀ ਦੇਰ ਤੱਕ ਕਰ ਸਕਾਂਗੀ ਕਿਉਂਕਿ ਮੈਂ ਕੰਮ ਲਈ ਲੇਟ ਹੋ ਰਹੀ ਹਾਂ